ਟੈਨੋਲਜੀ ਨੇ ਸਿੱਖਿਆ ਉਦਯੋਗ ਦੀ ਬਹੁਤ ਮਦਦ ਕੀਤੀ ਹੈ ਹੁਣ ਅਸੀਂ ਘਰ ਬੈਠੇ ਹੀ ਦੁਨੀਆ ਭਰ ਦੇ ਟੀਚਰਾਂ ਤੋਂ ਪੜ੍ਹ ਸਕਦੇ ਹਾਂ ਆਨਲਾਈਨ ਕਲਾਸਿਜ ਯੂਟਿਊਬ ਵੀਡੀਓ ਔਰ ਆਨਲਾਈਨ ਕੋਰਸ ਨੇ ਸਿੱਖਿਆ ਨੂੰ ਬਹੁਤ ਅਸੈਸਬਿਲਿਟੀਜ ਦਿੱਤੀ ਹੈ ਪਹਿਲਾਂ ਸਿਰਫ ਕਿਤਾਬਾਂ ਔਰ ਸਕੂਲ ਹੀ ਸਿੱਖਿਆ ਦਾ ਜ਼ਰੀਆ ਹੁੰਦਾ ਸੀ ਪਰ ਹੁਣ ਈ ਕਿਤਾਬਾਂ ਰਿਸਰਚ ਪੇਪਰ ਔਰ ਆਨਲਾਈਨ ਲਾਇਬਰੇਰੀਸ ਦੀ ਜ਼ਰੀਆ ਅਸੀਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਆਸਾਨੀ ਨਾਲ ਲੱਭ ਸਕਦੇ ਹਾਂ ਟੈਕਨੋਲੋਜੀ ਨੇ ਸਟੂਡੈਂਟਸ ਲਈ ਐਡਮਿਸ਼ਨ ਪ੍ਰੋਸੈਸ ਨੂੰ ਵੀ ਸੌਖਾ ਕਰ ਦਿੱਤਾ ਹੈ ਹੁਣ ਅਸੀਂ ਘਰ ਬੈਠੇ ਹੀ ਕਈ ਕਾਲਜਿਸ ਔਰ ਯੂਨੀਵਰਸਿਟੀ ਵਿੱਚ ਅਪਲਾਈ ਕਰ ਸਕਦੇ ਹਾਂ ਓਵਰਆਲ ਟੈਕਨੋਲੋਜੀ ਨੇ ਸਿੱਖਿਆ ਉਦਯੋਗ ਨੂੰ ਇੱਕ ਨਵਾਂ ਰੂਪ ਦਿੱਤਾ ਹੈ ਔਰ ਸਟੂਡੈਂਟਸ ਇਹ ਟੀਚਰ ਦੋਨਾਂ ਲਈ ਬਹੁਤ ਫਾਇਦਾ ਹੈ ਇਸ ਟੈਕਨੋਲੋਜੀ ਕਰਕੇ ਮੈਨੂੰ ਵੀ ਬਹੁਤ ਸੌਖ ਮਿਲੀ ਹੈ ਧੰਨਵਾਦ